ਇਸ ਹੁਣ ਦੇ ਸਮੇਂ ਵਿੱਚ ਬਹੁਤ ਜਾਪਦਾ ਹੈ ਕਿ ਲੋਕ ਖੇਤੀਬਾੜੀ ਵਿੱਚ ਉਲਝਣ ਨਾ ਹੋਣ ਦੀ ਚੋਣ ਕਰ ਰਹੇ ਨੇ ਨੇ ਪਰ ਇਸ ਬਾਰੇ ਇਹ ਬਹੁਤ ਹੀ ਗਲਤ ਖਿਆਲ ਹੈ ਕਿਉਂਕਿ ਖੇਤੀਬਾੜੀ ਦੀ ਮਹੱਤਤਾ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੀ ਹੈ ਕਿਉਂਕਿ ਖੇਤੀ ਦੇ ਨਾਲ ਹੀ ਅਸੀਂ ਸਬਜ਼ੀਆਂ ਫਲ਼ ਆਦਿ ਉਗਾ ਸਕਦੇ ਹਾਂ ਜੇਕਰ ਅਸੀਂ ਇਹਨਾਂ ਸਬਜ਼ਆਂ ਫਲ਼ਾਂ ਜਿਵੇਂ ਕਣਕਾਂ ਝੋਨਾ ਨਹੀਂ ਲਗਾਵਾਂਗੇ ਤਾਂ ਸਾਡੀ ਆਉਣ ਵਾਲੀ ਜ਼ਿੰਦਗੀ ਪੀੜੀ ਨੂੰ ਬਹੁਤ ਹੀ ਦਿੱਕਤਾਂ ਆਉਣਗੀਆਂ ਪ ਆਉਣੀਆਂ ਆਉਣਗੀਆਂ ਜਦੋਂ ਉਹ ਕਿਉਂਕਿ ਕਿਸਾਨ ਅੱਜ ਕੱਲ੍ਹ ਆਪਣਾ ਸਮਾਂ ਘਟਾਉਣ ਕਰਕੇ ਉਹ ਇਹਨਾਂ ਫਸਲਾਂ ਨੂੰ ਕਿਸੇ ਹੋਰ ਦੇ ਹਵਾਲੇ ਕਰ ਦਿੰਦਾ ਹੈ ਜੋ ਕਿ ਸਹੀ ਤਰ੍ਹਾਂ ਨਾਲ ਦੇਖ ਰੇਖ ਨਹੀਂ ਕਰਦੇ ਪਰ ਹਰੇਕ ਪਰਿਵਾਰ ਨੂੰ ਇਹ ਚਾਹੀਦਾ ਹੈ ਕਿ ਉਹ ਆਪਣਾ ਖੇਤੀਬਾੜੀ ਦਾ ਕੰਮ ਧਿਆਨ ਨਾਲ ਕਰਨ ਅਤੇ ਵਧੀਆ ਤਰੀਕੇ ਨਾਲ ਕਰਨ ਕਿਉਂਕਿ ਘਰ ਦੀ ਹਰੇਕ ਚੀਜ਼ ਆ ਹੁੰਦੀ ਹੈ ਅਤੇ ਉਸਦੇ ਆਪ ਦੇ ਹੱਥਾਂ ਨਾਲ ਕੀਤੀ ਹੋਈ ਖੇਤੀਬਾੜੀ ਨਾਲ ਇਹ ਹੁੰਦਾ ਹੈ ਕਿ ਉਹਨਾਂ ਨੂੰ ਕੀਟਨਾਸ਼ਕ ਜ਼ਹਿਰੀਲੇ ਪਦਾਰਥਾਂ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਜੇਕਰ ਉਹ ਖੇਤੀ ਨਹੀਂ ਕਰਨਗੇ ਤਾਂ ਉਹਨਾਂ ਨਾਲ ਉਹਨਾਂ ਦੀ ਜ਼ਿੰਦਗੀ 'ਤੇ ਬਹੁਤ ਮਾੜਾ ਪ੍ਰਭਾਵ ਪਵੇਗਾ ਪਰ ਖੇਤੀਬਾੜੀ ਦੇ ਨਾਲ ਮੇਰਾ ਇਸ ਬਾਰੇ ਇਹ ਕਹਿਣਾ ਹੈ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਅਤੇ ਆਉਣ ਵਾਲੀ ਜ਼ਿੰਦਗੀ ਲਈ ਖੇਤੀਬਾੜੀ ਬਹੁਤ ਹੀ ਇੱਕ ਮਹੱਤਵਪੂਰਨ ਹਿੱਸਾ ਹੈ ਜੇਕਰ ਅਸੀਂ ਅ ਤੰਦਰੁਸਤ ਰਹਿਣਾ ਹੈ ਤਾਂ ਸਾਨੂੰ ਖੇਤੀਬਾੜੀ 'ਤੇ ਵਿ ਵਿੱਚ ਰਹਿ ਕੇ ਹੋਣਾ ਪਵੇਗਾ ਕਿਉਂਕਿ ਖੇਤੀਬਾੜੀ ਕਰਦੇ ਸਮੇਂ ਅਸੀਂ ਆਪਣੇ ਸਰੀਰ ਦੀ ਵੀ ਮੂਵਮੈਂਟ ਕਰਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਤਾਜ਼ਾ ਸਬਜ਼ੀਆਂ ਫਲ਼ ਆਦਿ ਖਾਂਦੇ ਹਾਂ ਕਿਉਂਕਿ ਜੇਕਰ ਅਸੀਂ ਤਾਜ਼ਾ ਫਲ਼ ਅਤੇ ਸਬਜ਼ੀਆਂ ਖਾਵਾਂਗੇ ਤਾਂ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ